ਸਤਿ ਸ਼੍ਰੀ ਅਕਾਲ ਜੀ ਮੈਂ ਪੰਜਾਬ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਰਹਿੰਦੀ ਹਾਂ ਵੈਸੇ ਤਾਂ ਅੰਮ੍ਰਿਤਸਰ ਵਿੱਚ ਵੀਹ ਘੰਟੇ ਬਿਜਲੀ ਹੀ ਆਉਂਦੀ ਹੀ ਆਉਂਦੀ ਹੈ ਪਰ ਕਿਸੇ ਟਾਈਮ ਤਾਂ ਕਾਫ਼ੀ ਲੰਮੇ ਟਾਈਮ ਦਾ ਕੱਟ ਲੱਗ ਜਾਂਦਾ ਹੈ ਜਿੱਦਾਂ ਗਰਮੀਆਂ ਦੇ ਵਿੱਚ ਸਾਨੂੰ ਬਿਜਲੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਏ ਸੀ ਪੱਖਿਆਂ ਦੇ ਲਈ ਅਤੇ ਉਸ ਟਾਈਮ 'ਤੇ ਰਾਤ ਨੂੰ ਕਈ ਟਾਈਮ ਲੰਬਾ ਕੱਟ ਲੱਗ ਜਾਂਦਾ ਹੈ ਅਤੇ ਬਹੁਤ ਜ਼ਿਆਦਾ ਬਿਜਲੀ ਬੜੇ ਟਾਈਮ ਦੇ ਲਈ ਚਲੀ ਜਾਂਦੀ ਹੈ ਜਿੱਦਾਂ ਉੱਦਾਂ ਤਾਂ ਸਾਡੇ ਘਰ ਇਨਵੇਟਰ ਲੱਗਾ ਹੋਇਆ ਹੈ ਪਰ ਗਰਮੀਆਂ ਦੇ ਵਿੱਚ ਜ਼ਿਆਦਾ ਦੇਰ ਕੱਟ ਲੱਗਣ ਦੇ ਕਾਰਨ ਇਨਵੇਟਰ ਵੀ ਖ਼ਤਮ ਹੋ ਜਾਂਦਾ ਹੈ ਜਿਸ ਕਰਕੇ ਬੜੀ ਜ਼ਿਆਦਾ ਔਖ ਆਉਂਦੀ ਹੈ ਸਰਦੀਆਂ 'ਚ ਸਾਨੂੰ ਇੰਨੀ ਬਿਜਲੀ ਦੀ ਜ਼ਰੂਰਤ ਨਹੀਂ ਪੈਂਦੀ ਇਸ ਕਰਕੇ ਸਰਦੀਆਂ 'ਚ ਸਾਨੂੰ ਕੱਟ ਦਾ ਮਹਿਸੂਸ ਨਹੀਂ ਹੁੰਦਾ ਪਰ ਗਰਮੀਆਂ ਦੇ ਵਿੱਚ ਜਦੋਂ ਬਿਜਲੀ ਚਲੀ ਜਾਵੇ ਤਾਂ ਬੜੀ ਹੀ ਔਖ ਆਉਂਦੀ ਹੈ ਇਨਵੇਟਰ ਵੀ ਖਤਮ ਹੋ ਜਾਂਦਾ ਹੈ ਅਤੇ ਕਿਸੇ ਟਾਈਮ 'ਤੇ ਬਿਮਾਰ ਵਿਅਕਤੀ ਹੋਵੇ ਜਾਂ ਕਿਸੇ ਦੇ ਪੇਪਰ ਹੋਣ ਤਾਂ ਉਸਨੂੰ ਬੜੀਆਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਿਜਲੀ ਦੇ ਕਾਰਨ ਬੜੇ ਔਂਕੜ ਆਉਂਦੇ ਹਨ ਇਸ ਕਰਕੇ ਲੰਬੇ ਕੱਟ ਜਦੋਂ ਲੱਗ ਜਾਣ ਤਾਂ ਫਿਰ ਬੜੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਧੰਨਵਾਦ